ਮੈਂ ਤੁਹਾਡੀ ਊਬਰ ਦਾ ਕਦੋਂ ਤੱਕ ਕਦੋਂ ਦੀ ਉਡੀਕ ਕਰ ਰਹੀ ਹਾਂ ਹਜੇ ਤੱਕ ਊਬਰ ਕਿਉਂ ਨਹੀਂ ਆਈ ਮੈਨੂੰ ਡੇਢ ਘੰਟਾ ਹੋ ਗਿਆ ਉਰੇ ਤੁਹਾਡਾ ਇੰਤਜ਼ਾਰ ਕਰਦੇ ਹੋਏ ਪਰ ਹਜੇ ਤੱਕ ਤੁਸੀਂ ਮੈਨੂੰ ਲੈਣ ਨਹੀਂ ਆਏ ਅਤੇ ਮੈਨੂੰ ਮੇਰੇ ਕੰਮ 'ਤੇ ਜਾਣ ਲਈ ਵੀ ਦੇਰੀ ਹੋ ਰਹੀ ਹੈ ਅਗਰ ਤੁਸੀਂ ਨਹੀਂ ਆਉਣਾ ਮੈਨੂੰ ਦੱਸ ਦਿਉ ਮੈਂ ਦੂਜੀ ਊਬਰ ਬੁੱਕ ਕਰ ਲੈਂਦੀ ਹਾਂ